ਦੇਖੋ ਜਦੋਂ ਕਿਸੇ ਦੇ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਨਾ ਅਤੇ ਉਹਨੂੰ ਜ਼ਿਆਦਾਤਰ ਖਿਚੜੀ ਮੂੰਗੀ ਦੀ ਦਾਲ ਦੀ ਧੋਤੀ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਉਹ ਖਿਲਾਈ ਜਾਂਦੀ ਆ ਉਹਦੇ ਵਿੱਚ ਜਿੱਦਾਂ ਕਿ ਤੁਸੀਂ ਧੋਤੀ ਦੀ ਮੂੰਗੀ ਦਾਲ ਲੈ ਲਈ ਚਾਵਲ ਲੈ ਲਏ ਠੀਕ ਹੈ ਜੀ ਹਲਕਾ ਹਲਕਾ ਨਮਕ ਪਾ ਕੇ ਠੀਕ ਹੈ ਔਰ ਜੀ ਉਹ ਜੀਰਾ ਜੁਰਾ ਪਾ ਕੇ ਅਤੇ ਉਹ ਉਹਨੂੰ ਦਿੱਤਾ ਜਾਂਦਾ ਕਿ ਹਲਕਾ ਹੁੰਦਾ ਨੰਬਰ ਦੋ ਦਲੀਆ ਦਲੀਆ ਦਿੱਤਾ ਜਾਂਦਾ ਦਲੀਆ ਬਾਹਰੋਂ ਬਾਜ਼ਾਰ ਤੋਂ ਆਮ ਮਿਲ ਜਾਂਦਾ ਭੁੰਨਿਆ ਹੋਇਆ ਮਿਲ ਜਾਂਦਾ ਵਾ ਸਿੰਪਲ ਵੀ ਮਿਲ ਜਾਂਦਾ ਤਾਕਤ ਵਾਲੀ ਚੀਜ਼ ਆ ਦਲੀਆ ਅਤੇ ਉਹਨੂੰ ਬਣਾ ਕੇ ਕਈ ਲੋਕ ਮਿੱਠਾ ਬਣਾ ਕੇ ਖਾਂਦੇ ਆ ਕਈ ਨਮਕੀਨ ਬਣਾ ਕੇ ਖਾ ਲੈਂਦੇ ਆ ਅਤੇ ਕਈ ਵਾਰ ਹੁੰਦਾ ਕਿ ਜਦੋਂ ਫੁਲਕਾ ਦੇਣਾ ਹੁੰਦਾ ਜਦੋਂ ਬੰ ਜਦੋਂ ਬੰਦਾ ਜ਼ਿਆਦਾਤਰ ਵੈਸੇ ਕੋਈ ਹੋ ਜਾਵੇ ਨਾ ਬਿਮਾਰ ਹੋ ਜਾਵੇ ਮੂੰਗੀ ਦੀ ਦਾਲ ਬਣਾ ਲਓ ਸਿੰਪਲ ਫੁਲਕਾ ਖੁਸ਼ਕ ਫੁਲਕਾ ਇਹ ਬਣਾ ਕੇ ਉਹਨੂੰ ਦੇਵੋ ਉਹਦੇ ਵਾਸਤੇ ਇਹੋ ਚੀਜ਼ਾਂ ਹੁੰਦੀਆਂ ਵਾ ਪਕਵਾਨਾਂ ਵਿੱਚ ਹੁਣ ਹੋਰ ਤਾਂ ਕੋਈ ਚੀਜ਼ ਆਪਾਂ ਦੇ ਨਹੀਂ ਸਕਦੇ ਦਲੀਆ ਖਿਚੜੀ ਹੋ ਗਈ ਮੂੰਗੀ ਦੀ ਦਾਲ ਅਤੇ ਨਾਲ ਜਾਂ ਚੌਲ ਦੇ ਦਿਓ ਫਿੱਕੇ ਫਿੱਕੇ ਜਿਹੇ ਬਣਾ ਕੇ ਅਤੇ ਜਾਂ ਫੁਲਕਾ ਦੇ ਦਿਓ ਉਹ ਕੁਛ ਵੀ ਆ ਜਿਹੜਾ ਤੁਸੀਂ ਹੋਰ ਜੋ ਵੀ ਤੁਹਾਡੇ ਠੀਕ ਲੱਗਦਾ ਉਸ ਹਿਸਾਬ ਨਾਲ ਮਰੀਜ਼ ਨੇ ਚੌਲ ਖਾਣੇ ਆ ਉਹਨੂੰ ਚੌਲ ਦਿੱਤੇ ਜਾ ਸਕਦੇ ਆ ਮੂੰਗੀ ਦਾ ਦਾਲ ਦੇ ਨਾਲ ਜੇ ਰੋਟੀ ਖਾਣੀ ਹੈ ਤਾਂ ਰੋਟੀ ਦੇ ਦਿਓ ਉਹਨੂੰ ਧੰਨਵਾਦ ਜੀ